ਹੈਲੋ ਸਤਿ ਸ੍ਰੀ ਅਕਾਲ ਮੇਰੀ ਆਰ ਕੇ ਟੈਲੀਕੌਮ ਨਾਲ ਗੱਲ ਹੋ ਰਹੀ ਹੈ ਤੁਸੀਂ ਮੈਨੂੰ ਜਾਣਦੇ ਹੋਂਗੇ ਮੈਂ ਤੁਹਾਡੇ ਤੋਂ ਕੁਝ ਦਿਨ ਪਹਿਲਾਂ ਲੈਪਟੋਪ ਮੰਗਾਇਆ ਸੀ ਐੱਚ ਪੀ ਦਾ ਅਤੇ ਮੈਂ ਅੱਜ ਓਪਨ ਕੀਤਾ ਸੀ ਦੇਖ ਪੈਕਿੰਗ ਬਹੁਤ ਵਧੀਆ ਕੀਤੀ ਹੋਈ ਸੀ ਅਤੇ ਬਾਕੀ ਮੈਂ ਤਿੰਨ ਚਾਰ ਦਿਨ ਯੂਜ਼ ਕੀਤਾ ਚਲਾਣ 'ਚ ਵੀ ਵਧੀਆ ਲੱਗਿਆ ਕੰਡੀਸ਼ਨ ਵਧੀਆ ਸੀ ਜੋ ਮੈਂ ਸੋਚਿਆ ਸੀ ਉਸ ਤੋਂ ਵਧੀਆ ਚੱਲਦਾ ਹੈ ਹੈਂਗ ਵੀ ਨਹੀਂ ਹੁੰਦਾ ਹੈਗਾ ਐਪ ਵੀ ਵਰਕਿੰਗ ਕਰਦੇ ਆਂ ਕੋਈ ਵੀ ਪ੍ਰੋਬਲਮ ਨਹੀਂ ਆਈ ਮੈਨੂੰ ਹਲੇ ਤੱਕ ਬਾਕੀ ਮੈਂ ਇੰਸਟਾਗ੍ਰਾਮ ਤੋਂ ਦੇਖ ਕੇ ਔਡਰ ਕੀਤਾ ਸੀ ਤੁਹਾਡੇ ਤੋਂ ਅਤੇ ਬਾਕੀ ਮੈਂ ਹੋ ਹੋਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਰਿਕਮੈਂਡ ਕੀਤਾ ਸੀ ਤੁਹਾਡਾ ਅਤੇ ਹੁਣ ਬਾਕੀ ਜਿਹੜੀ ਡੀਲ ਆਈ ਹੋਈ ਹੈ ਇਹਦੀ ਫ਼ੋਨਾਂ ਦੀ ਫ਼ੋਨ ਦਾ ਵੀ ਅਸੀਂ ਦੇਖ ਰਹੇ ਆ ਫ਼ੋਨ ਵੀ ਔਡਰ ਕਰਨਾ ਆ ਅਤੇ ਬਾਕੀ ਹੋਰ ਗੈਜਟਸ ਜਿੱਦਾਂ ਏਅਰਪੋਰਡ ਵਗੈਰਾ ਉਹ ਮੈਂ ਆਪਣੇ ਫਰੈਂਡ ਨੂੰ ਵੀ ਦੱਸਣਾ ਹੈ ਅਤੇ ਲੈਪਟੋਪ ਦਾ ਕਲਰ ਵੀ ਬਹੁਤ ਵਧੀਆ ਸੀ ਬਾਕੀ ਧੰਨਵਾਦ ਥੈਂਕ ਯੂ ਜੀ